ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸਿਹਤ ਲਈ ਰਨਿੰਗ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਸਿਹਤ ਲਈ ਦੌੜ ਬਹੁਤ ਜ਼ਰੂਰੀ ਹੈ ਦੌੜ ਲਗਾਉਣ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਸਹੀ ਰਹਿੰਦਾ ਹੈ ਅਤੇ ਨਾਲ ਸਾਡੇ ਦਿਮਾਗ ਸ਼ਕਤੀ ਵੀ ਬਹੁਤ ਤੇਜ਼ ਹੁੰਦੀ ਹੈ ਅਤੇ ਸਾਡੇ ਸ਼ਰੀਰ ਨੂੰ ਤਾਕਤ ਮਿਲਦੀ ਹੈ ਅਤੇ ਦੌੜ ਨਾਲ ਹੀ ਸਾਡਾ ਦੌੜ ਨਾਲ ਹੀ ਸਾਡੀ ਤਨਾਅ ਵਗੈਰਾ ਦੂਰ ਹੁੰਦੀ ਹੈ ਦੌੜ ਦੌੜ ਲਗਾਉਣ ਨਾਲ ਸਾਡੀ ਸਰੀਰ ਦੀ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਨਾਲ ਸਵੇਰੇ ਸਵੇਰੇ ਤੁਹਾਨੂੰ ਦੌੜ ਲਗਾਉਣ ਨਾਲ ਸਹੀ ਸ ਤੰਦਰੁਸਤ ਹਵਾ ਪ੍ਰਾਪਤ ਹੁੰਦੀ ਹੈ ਦੌੜ ਲਗਾਉਣ ਨਾਲ ਹੀ ਸਾਡਾ ਮਾਨਸਿਕ ਸੰਤੁਲਨ ਸਹੀ ਰਹਿੰਦਾ ਹੈ ਅਤੇ ਸਾਨੂੰ ਸਵੇਰੇ ਸਵੇਰੇ ਦੌੜ ਲਗਾਉਣ ਨਾਲ ਜਿਹੜੀ ਹਵਾ ਮਿਲਦੀ ਹੈ ਉਹ ਸਾਡੇ ਸਿਹਤ ਲਈ ਬਹੁਤ ਤੰਦਰੁਸਤ ਆਦਿ ਮੰਨੀ ਜਾਂਦੀ ਹੈ ਦੌੜ ਲਗਾਉਣ ਨਾਲ ਹੀ ਸਾਡੀ ਜੀਵਨਸ਼ੀਲਾ ਜੀਵਨਸ਼ੀਲਾ ਵੱਧਦੀ ਹੈ ਅਤੇ ਦੌੜ ਲਗਾਉਣ ਨਾਲ ਹੀ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਦੌੜ ਲਗਾਉਣ ਨਾਲ ਹੀ ਸਾਡੀ ਦੌੜ ਲਗਾਉਣ ਨਾਲ ਹੀ ਸਾਡੀ ਬ੍ਰਿਥ ਪਾਵਰ ਵੱਧਦੀ ਹੈ ਦੌੜ ਲਗਾਉਣ ਨਾਲ ਹੀ ਸਾਡੇ ਖੂਨ ਪਤਲਾ ਹੁੰਦਾ ਹੈ ਅਤੇ ਸਾਡੀ ਵਿੱਚ ਜਾਨ ਆਉਂਦੀ ਹੈ ਦੌੜ ਲਗਾਉਣ ਨਾਲ ਹੀ ਸਾਡਾ ਜੀਵਨ ਸਰਕਲ ਵੱਧਦਾ ਹੈ ਅਤੇ ਸਾਨੂੰ ਤਾਕਤ ਮਿਲਦੀ ਹੈ ਦੌੜ ਲਗਾਉਣ ਨਾਲ ਹੀ ਸਾਡਾ ਡੇਲੀ ਸਰਕਲ ਚੱਲਦਾ ਚੱਲਦਾ ਹੈ ਅਤੇ ਦੌੜ ਲਗਾਉਣ ਨਾਲ ਹੀ ਸਾਨੂੰ ਕੁਛ ਸਮੇਂ ਤੱਕ ਆਰਾਮ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੀ ਸਾਹ ਵਗੈਰਾ ਦੀ ਦਿੱਕਤ ਨਹੀਂ ਆਉਂਦੀ ਦੁੱਧ ਪੀਣ ਨਾਲ ਸਾਡੇ ਅੰਦਰ ਐਨਰਜੀ ਆਉਂਦੀ ਹੈ ਅਤੇ ਦੌੜ ਦੌੜ ਲਗਾਉਣ ਵਾਲੇ ਬੰਦੇ ਨੂੰ ਨਾਲ ਨਾਲ ਪ੍ਰੋਟੀਨ ਵਗੈਰਾ ਵੀ ਪੀਣਾ ਚਾਹੀਦਾ ਹੈ ਦੌੜ ਲਗਾਉਣ ਨਾਲ ਹੀ ਸਾਡਾ ਜੀਵਨ ਅਤੇ ਵਿਕਾਸ ਹੁੰਦਾ ਹੈ ਸਾਨੂੰ ਇੱਕ ਡੇਲੀ ਰੂਟੀਨ ਬਣਾਉਣੀ ਚਾਹੀਦੀ ਹੈ ਡੇਲੀ ਰੂਟੀਨ ਵਿੱਚ ਸਾਨੂੰ ਰੋਜ਼ ਸਵੇਰ ਅਤੇ ਸ਼ਾਮ ਦੌੜ ਲਗਾਉਣੀ ਚਾਹੀਦੀ ਹੈ ਦੌੜ ਲਗਾਉਣ ਨਾਲ ਹੀ ਸਾਡਾ ਹਾਈਟ ਅਤੇ ਤਾਕਤ ਹਾਈਟ ਵੱਧਦੀ ਹੈ ਅਤੇ ਤਾਕਤ ਮਿਲਦੀ ਹੈ